ਲੋਕਾਂ ਦੇ ਕੱਪੜਿਆਂ ਦੇ ਵਿਸ਼ੇ ਵਿੱਚ ਸੋਚ ਅਲੱਗ ਅਲੱਗ ਹੈ ਸਮੇਂ ਦੀ ਘਾਟ ਹੋਣ ਕਰਕੇ ਅੱਜ ਕੱਲ੍ਹ ਲੋਕੀਂ ਰੇਡੀਮੇਟ ਕੱਪੜੇ ਪਾਉਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਸ ਵਿੱਚ ਸਮੇਂ ਦੀ ਬੱਚਤ ਹੁੰਦੀ ਹੈ ਲੋਕਾਂ ਦੇ ਵੱਧਦੇ ਰੁਝਾਨ ਕਰਕੇ ਰੇਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਜ਼ਿਆਦਾ ਹਨ ਪਰ ਸਾਡੇ ਬਜ਼ੁਰਗ ਅੱਜ ਵੀ ਹੱਥੀਂ ਸਿਲਾਈ ਕੀਤੇ ਕੁੜਤੇ ਪਜਾਮੇ ਪਾਉਣੇ ਜ਼ਿਆਦਾ ਪਸੰਦ ਕਰਦੇ ਹਨ ਹੱਥੀਂ ਸਿਲਾਈ ਕੀਤੇ ਕੱਪੜੇ ਅੱਜ ਦੇ ਸਮੇਂ ਵਿੱਚ ਮਹਿੰਗੇ ਪੈ ਰਹੇ ਹਨ ਰੇਡੀਮੇਡ ਕੱਪੜੇ ਸਸਤੇ ਪੈ ਰਹੇ ਹਨ ਅਤੇ ਇਹਨਾਂ ਦੀ ਵਰਾਇਟੀ ਜ਼ਿਆਦਾ ਹੋਣ ਕਾਰਨ ਲੋਕਾਂ ਦਾ ਇਹਨਾਂ ਵੱਲ ਰੁਝਾਨ ਜ਼ਿਆਦਾ ਹੈ